ਮੈਂ ਜਦੋਂ ਬਹੁਤ ਛੋਟੀ ਸੀ ਤਾਂ ਮੇਰੀ ਮਾਂ ਸਾਡੇ ਕੱਪੜੇ ਸੀਂਦੀ ਸੀ ਮੈਂ ਉਹਨਾਂ ਤੋਂ ਦੇਖ ਦੇਖ ਬਹੁਤ ਸ਼ੌਕ ਪੈਦਾ ਕੀਤਾ ਆਪਣੇ ਮਨ 'ਚ ਔਰ ਮੈਂ ਸਿਲਾਈ ਬੁਣਾਈ ਦਾ ਕੰਮ ਵੱਡੇ ਹੁੰਦੇ ਹੀ ਸ਼ੁਰੂ ਕਰ ਦਿੱਤਾ ਹੁਣ ਤਾਂ ਮੈਂ ਸਭ ਤਰ੍ਹਾਂ ਦੇ ਕੱਪੜੇ ਸੀ ਲੈਂਦੀ ਹਾਂ ਮੈਂ ਅੱਗੋਂ ਬੱਚਿਆਂ ਨੂੰ ਵੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਿਖਾ ਸਕਾਂ ਕਈ ਬੱਚੇ ਮੇਰੇ ਕੋਲ ਆਉਂਦੇ ਨੇ ਅਤੇ ਮੈਂ ਉਹਨਾਂ ਨੂੰ ਸਿਖਾਉਣੀ ਹਾਂ ਮੈਂ ਹੁਣ ਲੋਕਾਂ ਦੇ ਵੀ ਕੱਪੜੇ ਸੀਨੇ ਸ਼ੁਰੂ ਕਰ ਦਿੱਤੇ ਨੇ ਜਿਸ ਤਰ੍ਹਾਂ ਦਾ ਵੀ ਕੱਪੜਾ ਹੋਵੇ ਮੈਂ ਸੀ ਲੈਂਦੀ ਹਾਂ ਔਰ ਮੈਂ ਹੁਣ ਤਾਂ ਥੋੜ੍ਹੇ ਥੋੜ੍ਹੇ ਪੈਸੇ ਵੀ ਲੈਂਦੀ ਹਾਂ ਤਾਂ ਕਿ ਮੈਂ ਆਪਣੀ ਪੋਕਿਟ ਮਨੀ ਕੱਢ ਸਕਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਕਿ ਮੈਂ ਆਪਣੀ ਸਿਲਾਈ ਜਿੰਨੀ ਵੱਧ ਤੋਂ ਵੱਧ ਟਾਈਮ ਕੱਢ ਕੇ ਕਰ ਸਕਾਂ ਮੈਂ ਸਿਲਾਈ ਦਾ ਕੰਮ ਪੱਚੀ ਸਾਲ ਦੀ ਉਮਰ 'ਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਥੋੜ੍ਹਾ ਥੋੜ੍ਹਾ ਕਰਦੇ ਕਰਦੇ ਅੱਜ ਮੈਂ ਇਸ ਉਮਰ ਵਿਚ ਪਹੁੰਚ ਗਈ ਹਾਂ ਪਰ ਅੱਜ ਵੀ ਮੈਂ ਸਿਲਾਈ ਕਰਦੀ ਰਹਿੰਦੀ ਹਾਂ ਮੇਰਾ ਸਭ ਤੋਂ ਫੇਵਰੇਟ ਕੰਮ ਬਣ ਚੁੱਕਿਆ ਹੈ ਹੁਣ ਤਾਂ ਛੋਟਾ ਛੋਟਾ ਪੋਕਟ ਮਨੀ ਵੀ ਨਿਕਲਣ ਲੱਗ ਗਿਆ ਹੈ ਜਿਹਦਾ ਮੈਨੂੰ ਬਹੁਤ ਆਰਾਮ ਲੱਗਦਾ ਹੈ ਕਿ ਮੇਰੇ ਕੋਲੋਂ ਕੁੱਝ ਪੈਸੇ ਹੁੰਦੇ ਹਨ ਮੈਂ ਸਾਰੀ ਉਮਰ ਇਹੀ ਕੰਮ ਕਰਨਾ ਚਾਹੁੰਦੀ ਹਾਂ ਦੇਖੋ ਜਿੰਨੀ ਹਿੰਮਤ ਬਣੇਗੀ ਉਨੀ ਦੇਰ ਕਰਦੀ ਰਹੂੰਗੀ